ਹੈਲੋ ਮੈਂ ਸ਼੍ਰੀ ਗੁਰੂ ਹਰਿਮੰਦਰ ਸਾਹਿਬ ਜੀ ਅੰਮ੍ਰਿਤਸਰ ਜਾਣ ਲਈ ਓਲਾ ਕੈਬ ਬੁੱਕ ਕਰਨਾ ਚਾਹੁੰਦੀ ਹਾਂ ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਮੈਂ ਦਸ ਮਿੰਟਨ ਮਿੰਨਟ ਤੱਕ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਰੇਲਵੇ ਸਟੇਸ਼ਨ 'ਤੇ ਆ ਕੇ ਰੁਕਣਾ ਹੈ ਅਤੇ ਮੈਂ ਇਥੋਂ ਦਸ ਮਿੰਨਟ ਤੱਕ ਓਲਾ ਕੈਬ ਰਾਹੀਂ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਨੇੜੇ ਪੁੱਜਣਾ ਚਾਹੁੰਦੀ ਹਾਂ ਮੈਂ ਤੁਹਾਨੂੰ ਦਸ ਮਿੰਟ ਤੱਕ ਰੇਲਵੇ ਸਟੇਸ਼ਨ 'ਤੇ ਮਿਲਾਂਗੀ ਮੈਂ ਦੱਸਣਾ ਚਾਹੁੰਦੀ ਹਾਂ ਕਿ ਮੇਰਾ ਸਮਾਪਤੀ ਸਥਾਨ ਸ਼੍ਰੀ ਹਰਿਮੰਦਰ ਸਾਹਿਬ ਜੀ ਹੈ ਅਤੇ ਮੈਂ ਉੱਥੇ ਸਾਢੇ ਦਸ ਵਜੇ ਤੱਕ ਪੁੱਜਣਾ ਹੈ ਤੁਸੀਂ ਮੇਰੇ ਲਈ ਇੱਕ ਓਲਾ ਕੈਬ ਬੁੱਕ ਕਰ ਦਿਓ ਤਾਂ ਜੋ ਮੈਂ ਰੇਲਵੇ ਸਟੇਸ਼ਨ ਤੋਂ ਉਤਰ ਕੇ ਕੈਬ ਵਿੱਚ ਬੈਠ ਕੇ ਆਪਣੇ ਸਥਾਨ 'ਤੇ ਪੁੱਜ ਸਕਾਂ ਤੁਸੀਂ ਮੈਨੂੰ ਕੈਬ ਡਰਾਈਵਰ ਦੀ ਡਿਟੇਲ ਈਮੇਲ ਰਾਹੀਂ ਭੇਜ ਸ ਦਿਓ ਡਰਾਈਵਰ ਦੇ ਆਉਣ ਦਾ ਵਕਤ ਵੀ ਦੱਸ ਦਿਓ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਡਰਾਈਵਰ ਕਦੋਂ ਤੱਕ ਆ ਰਿਹਾ ਹੈ ਕਿਰਪਾ ਕਰਕੇ ਕੈਬ ਨੂੰ ਜਲਦੀ ਤੋਂ ਜਲਦੀ ਭਿਜਵਾਉਣ ਦੀ ਕਿਰਪਾਲਤਾ ਕਰੋ ਧੰਨਵਾਦ